ਜਿਵੇਂ ਕਿ ਸਾਨੂੰ ਪਤਾ ਹੈ ਕਿ ਜ਼ਿੰਦਗੀ ਵਿੱਚ ਖੁਸ਼ ਰਹਿਣਾ ਬਹੁਤ ਹੀ ਮਹੱਤਤਾ ਰੱਖਦਾ ਹੈ ਸਾਡੀ ਸਿਹਤ ਲਈ ਵੀ ਅਤੇ ਆਸ ਪਾਸ ਦੇ ਅਗਰ ਗੱਲ ਕਰੀਏ ਕਿ ਜਿਹੜੇ ਸਾਡੇ ਆਸ ਪਾਸ ਲੋਕ ਰਹਿੰਦੇ ਹਨ ਅਗਰ ਅਸੀਂ ਖੁਦ ਖੁਸ਼ ਰਹਾਂਗੇ ਤਾਂ ਜੋ ਸਾਡੇ ਆਸ ਪਾਸ ਜੋ ਰਹਿੰਦੇ ਜੋ ਸਾਡਾ ਦੋਸਤ ਹਨ ਜੋ ਸਾਡਾ ਫਰੈਂਡ ਸਰਕਲ ਹੈ ਜਾਂ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ ਅਗਰ ਅਸੀਂ ਆਪਣੇ ਆਪ ਨੂੰ ਖੁਸ਼ ਰੱਖਾਂਗੇ ਅਸੀਂ ਉਹਨਾਂ ਨਾਲ ਖੁਸ਼ ਹੋ ਕੇ ਅਸੀਂ ਉਹਨਾਂ ਨਾਲ ਵਰਤਾ ਕਰਾਂਗੇ ਤਾਂ ਉਹਨਾਂ ਦੇ ਵੀ ਬਹੁਤ ਵਧੀਆ ਇੱਕ ਵਾਤਾਵਰਨ ਬਣਿਆ ਰਹੇਗਾ ਇਸ ਲਈ ਜੋ ਖੁਸ਼ ਰਹਿਣਾ ਏ ਸਾਡੀ ਹਰੇਕ ਦੀ ਜ਼ਿੰਦਗੀ ਲਈ ਬਹੁਤ ਮਹੱਤਤਾ ਰੱਖਦਾ ਹੈ ਅਗਰ ਗੱਲ ਕੀਤੀ ਜਾਵੇ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਹਨਾਂ ਤੋਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਜਿਵੇਂ ਕਿ ਗੱਲ ਕੀਤੀ ਜਾਵੇ ਅਗਰ ਮੈਂ ਆਪਣੀ ਖੁਸ਼ ਰਹਿਣ ਦੀ ਤਾਂ ਅਗਰ ਮੈਂ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੁੰਦੀ ਹਾਂ ਤਾਂ ਮੈਂ ਆਪਣੇ ਆਪ ਨੂੰ ਇਕੱਲਾ ਰਹਿ ਕੇ ਮਤਲਬ ਕਿ ਆਪਣੇ ਆਪ ਘਰਦਿਆਂ ਨਾਲ ਇਕੱਲੀ ਆਪਣੇ ਘਰਦਿਆਂ ਨਾਲ ਸਮਾਂ ਬਿਤਾਉਣਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਮੈਨੂੰ ਖੁਸ਼ ਲੱਗਦਾ ਕਿ ਮੈਂ ਆਪਣੇ ਘਰਦਿਆਂ ਨਾਲ ਸਮਾਂ ਬਿਤਾਉਂਦੀ ਹਾਂ ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਕਿ ਮੈਂ ਜਿਹਨਾਂ ਕਰਕੇ ਮੈਂ ਖੁਸ਼ ਰਹਿੰਦੀ ਹਾਂ ਅਗਰ ਮੈਂ ਹੋਬੀਸ ਵਿੱਚ ਅਗਰ ਬਹੁਤ ਸਾਰੀਆਂ ਮੇਰੀਆਂ ਅਜਿਹੀਆਂ ਹੋਬੀਸ ਵੀ ਹਨ ਜਿਹਨਾਂ ਨੂੰ ਕਰਕੇ ਮੈਂ ਆਪਣੇ ਆਪ ਨੂੰ ਖੁਸ਼ ਰੱਖਦੀ ਹਾਂ ਜਿਵੇਂ ਕਿ ਮੈਂ ਆਪਣੇ ਘਰ ਥੋੜ੍ਹੀ ਬਹੁਤ ਗਾਰਡਨਿੰਗ ਜਿਹਨੂੰ ਬਾਗਬਾਨੀ ਕਹਿ ਦਿੰਦੇ ਹਾਂ ਗਾਰਡਨਿੰਗ ਕਰਦੀ ਹਾਂ ਬਲਕਿ ਫੁੱਲ ਵਗੈਰਾ ਲਗਾਏ ਹੋਏ ਹਨ ਜਾਂ ਸਬਜ਼ੀਆਂ ਲਗਾਈਆਂ ਹੋਣ ਅਗਰ ਉਹਨਾਂ ਨੂੰ ਮੈਂ ਪਾਣੀ ਦਿੰਦੀ ਹਾਂ ਤਾਂ ਉਹ ਉਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਕਿ ਮੈਂ ਕੁਛ ਕਰ ਰਹੀ ਹਾਂ ਕੰਮ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਬਿਜ਼ੀ ਰੱਖਣ ਵਿੱਚ ਬਹੁਤ ਖੁਸ਼ ਹਾਂ ਅਗਰ ਮੈਂ ਵੇਹਲੀ ਰਹਾਂ ਤਾਂ ਵੇਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਅਗਰ ਮੈਂ ਵਿਹਲੀ ਰਹਾਂ ਤਾਂ ਤਾਂ ਮੇਰੇ ਮਨ ਵਿੱਚ ਕੁਛ ਇੱਦਾਂ ਦੇ ਖਿਆਲ ਹੁੰਦੇ ਹਨ ਉਹ ਵੇਹਲੇ ਟਾਈਮ ਮੈਂ ਆਪਣੇ ਆਪ ਨੂੰ ਬਹੁਤ ਘੱਟ ਮਤਲਬ ਕਿ ਸਮਝਦੀ ਹਾਂ ਕਿ ਮੈਂ ਖੁਸ਼ ਰਹਿੰਦੀ ਹਾਂ ਕਿਉਂਕਿ ਵੇਹਲੇ ਟਾਈਮ ਵੇਹਲੇ ਮੈਂ ਹੋਵਾਂ ਤਾਂ ਮੇਰਾ ਜੋ ਧਿਆਨ ਹੈ ਬਹੁਤ ਹੀ ਆਸ ਪਾਸ ਜਾਂਦਾ ਰਹਿੰਦਾ ਕੁਛ ਨੈਗੇਟਿਵ ਚੀਜ਼ਾਂ ਵੀ ਮੈਂ ਸੋਚਦੀ ਰਹਿੰਦੀ ਹਾਂ ਇਸ ਲਈ ਜੋ ਜ਼ਿਆਦਾਤਰ ਮੈਂ ਇਹੀ ਚਾਹੁੰਦੀ ਹਾਂ ਕਿ ਮੈਂ ਆਪਣੇ ਆਪ ਨੂੰ ਕਿਸੇ ਇਸ ਕੰਮ ਵਿੱਚ ਬਿਜ਼ੀ ਰੱਖਾਂ ਜਿਹਦੇ ਤੋਂ ਮੈਨੂੰ ਖੁਸ਼ੀ ਮਿਲੇ ਜਿਵੇਂ ਕਿ ਮੈਂ ਬਾਗਬਾਨੀ ਕਰਦੀ ਹਾਂ ਤਾਂ ਮੈਂ ਫੁੱਲਾਂ ਨੂੰ ਪਾਣੀ ਦੇਣਾ ਹੈ ਨਾ ਸਬਜ਼ੀਆਂ ਲਗਾਈਆਂ ਹੋਣ ਉਸਨੂੰ ਪਾਣੀ ਦੇਣਾ ਉਸ ਦੀ ਦੇਖਭਾਲ ਕਰਨੀ ਘਰਦਿਆਂ ਨਾਲ ਜ਼ਿਆਦਾ ਟਾਈਮ ਬੈਠ ਕੇ ਗੱਲਾਂ ਕਰਨੀਆਂ ਟਾਈਮ ਬਿਤਾਉਣਾ ਆਪਣਾ ਜੋ ਵੀ ਰੋਜ਼ ਆਪਣੇ ਕੰਮ ਤੋਂ ਜੋ ਮੈਂ ਸਿੱਖਦੀ ਹਾਂ ਜਾਂ ਕੰਮ ਤੋਂ ਜੋ ਵੀ ਹੋਇਆ ਮੈ ਆਪਣੇ ਘਰ ਜਾ ਕੇ ਦੱਸਣਾ ਕੋਈ ਵੀ ਆਪਣੇ ਦੋਸਤਾਂ ਵਿੱਚ ਮੈਂ ਬਹੁਤ ਖੁਸ਼ ਰਹਿੰਦੀ ਹਾਂ ਆਪਣੇ ਦੋਸਤ ਨਾਲ ਗੱਲ ਕਰਨੀ ਆਪਣੇ ਦੋਸਤਾਂ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਨੀਆਂ ਉਹਨਾਂ ਨਾਲ ਬਹਿ ਕੇ ਖਾਣਾ ਖਾਣਾ ਇਹ ਚੀਜ਼ਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ ਰੱਖਦੀਆਂ ਹਨ